ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਰ ਸਰ ਮੈਂ ਨਾ ਤੁਹਾਡੇ ਰੈਸਟੋਰੈਂਟ ਤੋਂ ਸਵਿੱਗੀ ਦੇ ਜ਼ਰੀਏ ਔਰਡਰ ਬੁੱਕ ਕੀਤਾ ਸੀਗਾ ਔਡਰ ਕਨਫਰਮ ਵੀ ਹੋ ਗਿਆ ਅਤੇ ਉਸ ਦਾ ਡਿਲੀਵਰੀ ਦਾ ਜਿਹੜਾ ਟਾਈਮ ਸੀਗਾ ਉਹ ਵੀ ਸ਼ੋਅ ਹੋ ਰਿਹਾ ਸੀਗਾ ਕਿ ਹਾਂਜੀ ਦੁਪਹਿਰੇ ਇੰਨੇ ਵਜੇ ਤੱਕ ਦੋ ਵਜੇ ਤੱਕ ਜਿਹੜਾ ਤੁਹਾਡਾ ਔਡਰ ਹੈ ਉਹ ਡਿਲੀਵਰ ਹੋ ਜੇਗਾ ਪਰ ਹੁਣ ਦਿੱਤੇ ਗਏ ਟਾਈਮ ਤੋਂ ਦਸ ਵੀਹ ਮਿੰਟ ਉੱਪਰ ਹੋ ਚੁੱਕੇ ਨੇ ਮੈਂ ਡਿਲੀਵਰੀ ਪਾਰਟਨਰ ਨੂੰ ਕੋਲ ਵੀ ਕਿੰਨੀ ਵਾਰੀ ਕਰਕੇ ਦੇਖਿਆ ਪਰ ਹਜੇ ਤੱਕ ਮੇਰਾ ਜਿਹੜਾ ਔਰਡਰ ਹੈ ਉਹ ਮੇਰੇ ਘਰ ਤੱਕ ਡਿਲੀਵਰ ਨਹੀਂ ਹੋਇਆ ਮੈਂ ਪਹਿਲਾਂ ਵੀ ਬੜੀ ਵਾਰੀ ਤੁਹਾਡੇ ਰੈਸਟੋਰੈਂਟ ਤੋਂ ਔਡਰ ਕੀਤੇ ਨੇ ਹਰ ਵਾਰੀ ਟਾਈਮ 'ਤੇ ਹੀ ਆਉਂਦਾ ਹੈ ਸੋ ਇਸ ਵਾਰੀ ਮੇਰੇ ਘਰ ਪਾਰਟੀ ਸੀ ਅਤੇ ਮੈਂ ਇਸੇ ਹਿਸਾਬ ਦੇ ਨਾਲ ਹੀ ਜਿਹੜਾ ਸੀ ਔਡਰ ਤੁਹਾਡੇ ਰੈਸਟੋਰੈਂਟ ਤੋਂ ਮੰਗਵਾਇਆ ਕਿ ਹਾਂਜੀ ਡਿਲੀਵਰੀ ਜਿਹੜੀ ਉਹ ਬਿਲਕੁਲ ਟਾਈਮ 'ਤੇ ਉਹ ਜਾਂਦੀ ਹੈ ਪਰ ਹੁਣ ਪਿਛਲੇ ਦ ਦਸ ਪੰਦਰਾਂ ਮਿੰਟ ਤੋਂ ਵੇਟ ਕਰ ਰਹੇ ਹਾਂ ਕੋਈ ਵੀ ਨਾ ਹੀ ਉਹ ਸਾਡੇ ਕਾਲ ਪਿੱਕ ਕਰ ਰਹੇ ਹਾਂ ਨਾ ਹੀ ਦੱਸ ਰਹੇ ਨੇ ਕਿ ਕਿਸ ਔਡਰ ਜਿਹੜਾ ਹੈ ਉਹ ਕਿੱਥੇ ਹੈਗਾ ਹੈ ਕਦ ਤੱਕ ਆਵੇਗਾ ਮੈਂ ਕੋਲ ਕਰ ਕਰ ਕੇ ਥੱਕ ਚੁੱਕੀ ਹਾਂ ਮੇਰੇ ਗੈਸਟ ਦੇ ਜਾਣ ਦਾ ਹੁਣ ਸਮਾਂ ਹੋ ਚੁੱਕਾ ਹੈ ਪਰ ਹਜੇ ਵੀ ਕੋਈ ਡਿਲੀਵਰੀ ਦੀ ਜਿਹੜੀ ਹੈਗੀ ਹੈ ਉਹ ਕਿਸੇ ਤਰੀਕੇ ਦਾ ਵੀ ਉਸ ਪਾਰਟਨਰ ਨਾਲ ਸੰਪਰਕ ਨਹੀਂ ਹੋ ਪਾਇਆ ਸੋ ਪਲੀਜ਼ ਤੁਸੀਂ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਮੈਨੂੰ ਪਤਾ ਲੱਗ ਸਕੇ ਕਿ ਮੇਰਾ ਜਿਹੜਾ ਔਡਰ ਹੈ ਉਹ ਕਿੱਥੇ ਤੱਕ ਆ ਚੁੱਕਿਆ ਹੈ ਔਡਰ ਆਵੇਗਾ ਵੀ ਕਿ ਨਹੀਂ ਤਾਂ ਕਿ ਮੈਂ ਆਪਣੇ ਜਿਹੜਾ ਹੈਗਾ ਪਾਰਟੀ ਦਾ ਅਗਰ ਦੁਬਾਰਾ ਔਡਰ ਕਰਨਾ ਦੈੱਨ ਫਿਰ ਮੈਂ ਉਹਨੂੰ ਹੋਰ ਕਿਤਿਓਂ ਬੁੱਕ ਕਰ ਲਵਾਂ